ਪੰਜਾਬ ਵਿੱਚ ਪ੍ਰਮੁੱਖ ਪੰਜਾਬੀ ਲੋਕ ਸੰਗੀਤ ਹੈ ਅਤੇ ਨ੍ਰਿਤ ਹੈ ਜਿਸ ਨੂੰ ਨਾ ਸਿਰਫ ਪੰਜਾਬ ਵਿੱਚ ਬਲਕਿ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਇਹ ਤਿਉਹਾਰ ਜਿਵੇਂ ਕਿ ਵਿਸਾਖੀ ਲੋਹੜੀ ਇਹਨਾਂ ਤਿਉਹਾਰਾਂ ਨੂੰ ਰਵਾਇਤੀ ਕੱਪੜਿਆਂ ਨਾਲ ਪਹਿਨ ਕੇ ਮਨਾਇਆ ਜਾਂਦਾ ਹੈ ਇਹ ਤਿਉਹਾਰ ਢੋਲ ਧਮੱਕਿਆਂ ਦੁਆਰਾ ਮਨਾਇਆ ਜਾਂਦਾ ਹੈ ਇਸ ਨੂੰ ਹਰ ਵਰਗ ਦੇਖਣਾ ਸੁਣਨਾ ਅਤੇ ਕਰਨਾ ਪਸੰਦ ਕਰਦਾ ਹੈ ਇਹ ਇੱਕ ਵੱਡੇ ਦਰਸ਼ਕ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ